ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਮੈਨੂੰ ਨਾ ਇੱਕ ਫਲੈਟ ਚਾਹੀਦਾ ਸੀ ਰਣਜੀਤ ਐਵਨਿਊ 'ਚ ਤਾਂ ਉਹਦੀ ਕਿੰਨਾ ਕੁ ਰੇਟ ਹੋਏਗਾ ਕਿਹੜੀ ਹੈਗੀ ਆ ਤਾਂ ਉਹ ਮੈਨੂੰ ਦੱਸ ਦੋਗੇ ਜ਼ਰਾ ਠੀਕ ਹੈ ਜੀ ਓਕੇ ਓਕੇ ਜੀ